ਪੰਜ ਨਵੰਬਰ ਉੱਨੀ ਸੌ ਬਿਆਸੀ ਅਠਾਰਾਂ ਅਕਤੂਬਰ ਉੱਨੀ ਸੌ ਅੱਸੀ ਸੱਤ ਫਰਵਰੀ ਦੋ ਹਜ਼ਾਰ ਛੇ ਸੋਲ਼ਾਂ ਅਗਸਤ ਦੋ ਹਜ਼ਾਰ ਪੰਜ ਚੌਦਾਂ ਨਵੰਬਰ ਦੋ ਹਜ਼ਾਰ ਅਠਾਰਾਂ